ਸਾਡੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਵੈਸੇ ਤਾਂ ਕਈ ਤਰ੍ਹਾਂ ਦੇ ਕਿੱਤੇ ਅਪਣਾਏ ਅਪਣਾਏ ਜਾਂਦੇ ਹਨ ਪਰ ਇੱਥੋਂ ਦੇ ਲੋਕ ਬਾਹਰਲੇ ਦੇਸ਼ ਜਾਣ ਦਾ ਰੁਝਾਨ ਬਹੁਤ ਰੱਖਦੇ ਹਨ ਇ ਇੱਥੋਂ ਦੇ ਲੋਕਾਂ ਦਾ ਬਾਹਰਲੇ ਦੇਸ਼ ਜਾਣ ਦਾ ਇੰਨਾ ਰੁਝਾਨ ਹੈ ਕਿ ਘਰ ਹਰ ਘਰ ਵਿੱਚੋਂ ਇੱਕ ਦੋ ਮੈਂਬਰ ਤਾਂ ਜ਼ਰੂਰ ਬਾਹਰ ਗਏ ਹੋਏ ਹਨ ਇੱਥੋਂ ਦੇ ਲੋਕਾਂ ਨੇ ਬਾਹਰ ਜਾ ਕੇ ਵੀ ਆਪਣੇ ਵਿਰਸੇ ਨੂੰ ਸੰਭਾਲਿਆ ਹੋਇਆ ਹੈ ਅਤੇ ਉਹ ਪਿੰਡ ਦੇ ਵਿਕਾਸ ਵਿੱਚ ਬਹੁਤ ਮਦਦ ਕਰਦੇ ਹਨ ਉਨ੍ਹਾਂ ਨੇ ਸਕੂਲ ਦੇ ਸਕੂਲ ਦੇ ਵਿਕਾ ਸਕੂਲ ਦੀ ਹਾਲਤ ਸੁਧਾਰਨ ਲਈ ਵੀ ਕਾਫ਼ੀ ਯੋਗਦਾਨ ਪਾਇਆ ਹੈ ਅਤੇ ਪਿੰਡ ਦੇ ਹੋਰ ਵੀ ਕਈ ਕੰਮਾਂ ਵਿੱਚ ਸੁਧਾਰ ਕੀਤਾ ਹੈ